ਸਾਡੀ ਗਾਇਕੀ ਵਿੱਚ ਭਾਈ ਭਾਵਨਾਵਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਅਸੀਂ ਵਧੀਆ ਗਾਣੇ ਗਾਉਂਦੇ ਹਾਂ ਖੁਸ਼ੀ ਵਾਲੇ ਜੇ ਅਸੀਂ ਦੁਖੀ ਹੁੰਦੇ ਹਾਂ ਤਾਂ ਸਾਡੇ ਅੰਦਰੋਂ ਜਿਹੜਾ ਦੁੱਖ ਹੈ ਉਹ ਸਾਡੇ ਗਾਇਕੀ ਰਾਹੀਂ ਨਿਕਲ ਕੇ ਬਾਹਰ ਆਉਂਦਾ ਹੈ ਜੇ ਕਿਸੇ ਦੀ ਕਿਵੇਂ ਦਾ ਘਰ ਦੇ ਹਾਲਾਤ ਹੋਣਗੇ ਜਿਵੇਂ ਦੀ ਚੀਜ਼ਾਂ 'ਚ ਗੁਜਰਿਆ ਹੋਇਆ ਤਾਂ ਉਹ ਉਵੇਂ ਦੇ ਹੀ ਗਾਣੇ ਲਿਖੇਗਾ ਉਵੇਂ ਦੇ ਗਾਣੇ ਗਾਵੇਗਾ ਉਹਦੀਆਂ ਉਵੇਂ ਭਾਵਨਾਵਾਂ ਕੰਮ ਕਰਨਗੀਆਂ ਅਸੀਂ ਇਹਨਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਆਪਾਂ ਜਦੋਂ ਦੁਖੀ ਹਾਂ ਤਾਂ ਇਸ ਚੀਜ਼ ਨੂੰ ਮਹਿਸੂਸ ਕਰਕੇ ਗਾਣਾ ਗਾਵਾਂਗੇ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਾਂਗੇ